ਮੈਨੂੰ ਬਚਪਨ ਤੋਂ ਹੀ ਪੇਂਟਿੰਗ ਦਾ ਬਹੁਤ ਸ਼ੌਂਕ ਸੀ ਮੈਂ ਆਪਣੇ ਜੀਵਨ ਵਿੱਚ ਪੇਂਟਿੰਗ ਦਾ ਸ਼ੌਂਕ ਮੈਨੂੰ ਸ਼ੁਰੂ ਤੋਂ ਹੀ ਬਹੁਤ ਸੀ ਅ ਤੇ ਜਦੋਂ ਮੈਂ ਬਚਪਨ ਵਿੱਚ ਛੋਟੀ ਜਿਹੀ ਸੀ ਮੈਨੂੰ ਉਦੋਂ ਹੀ ਤਸਵੀਰਾਂ ਬਣਾਉਂਦੀ ਹੁੰਦੀ ਸੀ ਜਦੋਂ ਮੈਂ ਕੋਈ ਚੀਜ਼ ਵੇਖ ਲੈਂਦੀ ਸੀ ਤਾਂ ਮੈਂ ਉਸਦੀ ਪੇਂਟਿੰਗ ਕਰਨੀ ਸ਼ੁਰੂ ਕਰ ਦਿੰਦੀ ਸੀ ਅਤੇ ਫਿਰ ਇਸ ਨੂੰ ਮੈਂ ਵੱਡੇ ਹੋ ਕੇ ਕਿੱਤਾ ਮੁਖੀ ਕਰਨਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਜਦੋਂ ਮੈਂ ਥੋੜ੍ਹੀ ਜਿਹੀ ਵੱਡੀ ਹੋਈ ਤਾਂ ਮੈਂ ਜਿਹੜਾ ਪੇਂਟਿੰਗ ਸੀ ਉਹਨੂੰ ਐਜ ਏ ਸਬਜੈਕਟ ਲੈ ਲਿਆ ਅਤੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਡਿਗਰੀ ਵੀ ਜਿਹੜੀ ਸੀ ਉਹ ਪੇਂਟਿੰਗ ਦੇ ਵਿੱਚ ਹੀ ਕੀਤੀ ਫਿਰ ਪੇਂਟਿੰਗ ਦੇ ਵਿੱਚ ਡਿਗਰੀ ਕਰਨ ਤੋਂ ਬਾਅਦ ਮੈਂ ਹੁਣ ਇਸ ਟਾਈਮ ਪ੍ਰੋਫੈਸਰ ਹਾਂ ਪੇਂਟਿੰਗ ਦੀ ਅਤੇ ਪੇਂਟਿੰਗ ਮੈਂ ਜਦੋਂ ਬੱਚਿਆਂ ਨੂੰ ਸਿਖਾਉਂਦੀ ਹਾਂ ਤਾਂ ਮੈਨੂੰ ਬਹੁਤ ਵਧੀਆ ਜਿਹੜਾ ਵਾ ਉਹ ਮਹਿਸੂਸ ਹੁੰਦਾ ਵਾ ਕਿ ਮੈਂ ਜਿਹੜਾ ਮੇਰਾ ਸੁਪਨਾ ਸੀ ਮੈਂ ਉਹਨੂੰ ਹੀ ਅੱਗੇ ਲੈ ਕੇ ਗਈ ਅਤੇ ਪੇਂਟਿੰਗ ਨੂੰ ਮੈਂ ਆਪਣਾ ਜਿਹੜਾ ਵਾ ਉਹ ਇੱਕ ਕੈਰੀਅਰ ਬਣਾਇਆ